ਪਹਿਲੇ ਸਮੇਂ ਵਿੱਚ ਜ਼ਿਆਦਾਤਰ ਤਾਂ ਲੋਕਾਂ ਨੂੰ ਕੋਲਡ ਫੀਵਰ ਵਾਇਰਲ ਫੀਰਵ ਫੀਵਰ ਵਰਗੀਆਂ ਆਮ ਬਿਮਾਰੀਆਂ ਹੀ ਹੁੰਦੀਆਂ ਸਨ ਪਰ ਜਿਵੇਂ ਜਿਵੇਂ ਸਮਾਂ ਬਦਲਦਾ ਜਾ ਰਿਹਾ ਹੈ ਪਲਿਊਸ਼ਨ ਵੱਧਦਾ ਜਾ ਰਿਹਾ ਹੈ ਲੋਕਾਂ ਦਾ ਖਾਣਾ ਪੀਣਾ ਖਰਾਬ ਹੁੰਦਾ ਜਾ ਰਿਹਾ ਹੈ ਅਤੇ ਬਿਮਾਰੀਆਂ ਵੀ ਵੱਧਦੀਆਂ ਜਾ ਰਹੀਆਂ ਹਨ ਜਿਵੇਂ ਥੋੜ੍ਹਾ ਸਮਾਂ ਪਹਿਲਾਂ ਹੀ ਕਰੋਨਾ ਵਰਗੀ ਛੂਤ ਦੀ ਬਿਮਾਰੀ ਸਾਰੇ ਵਰਲਡ ਵਿੱਚ ਫੈਲ ਗਈ ਸੀ ਅਤੇ ਇਹ ਬਿਮਾਰੀ ਚੀਨ ਤੋਂ ਹੀ ਸ਼ੁਰੂ ਹੋਈ ਸੀ ਇਹ ਇੱਕ ਦੂਜੇ ਦੇ ਸੰਪਰਕ ਵਿੱਚ ਆਉਣ ਨਾਲ ਫੈਲੀ ਸੀ ਜਿਸ ਨਾਲ ਆਏ ਦਿਨ ਹੀ ਲੱਖਾਂ ਵਿੱਚ ਮੌਤਾਂ ਹੋਈਆਂ ਸਨ ਜ਼ਿਆਦਾਤਰ ਗਰਮੀਆਂ ਵਿੱਚ ਅਤੇ ਬਰਸਾਤਾਂ ਵਿੱਚ ਕਾਫੀ ਜ਼ਿਆਦਾ ਮੱਛਰ ਵੱਧ ਜਾਂਦਾ ਹੈ ਜਿਸ ਕਰਕੇ ਡੇਂਗੂ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਫੈਲ ਰਹੀਆਂ ਹਨ ਲੋਕਾਂ ਨੂੰ ਹਰ ਸਾਲ ਇਹਨਾਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਡੇਂਗੂ ਕਰਕੇ ਕਈ ਵਾਰ ਤਾਂ ਮੌਤਾਂ ਵੀ ਹੋ ਜਾਂਦੀਆਂ ਹਨ ਬਰਸਾਤਾਂ ਵਿੱਚ ਆਈ ਫਲਿਊ ਹੈਜ਼ਾ ਵਰਗੀਆਂ ਬਿਮਾਰੀਆਂ ਫੈਲਦੀਆਂ ਹਨ ਟੀ ਬੀ ਵਰਗੀ ਬਿਮਾਰੀ ਵੀ ਇੱਕ ਛੂਤ ਦੀ ਬਿਮਾਰੀ ਹੈ ਜੋ ਇੱਕ ਦੂਜੇ ਦੇ ਸੰਪਰਕ ਵਿੱਚ ਆਉਣ ਨਾਲ ਫੈਲਦੀ ਹੈ ਅੱਜ ਕੱਲ੍ਹ ਤਾਂ ਟਾਈਫਾਈਡ ਵਰਗੀ ਬਿਮਾਰੀ ਵੀ ਆਮ ਹੀ ਹੋ ਗਈ ਹੈ ਸਰਦੀਆਂ ਵਿੱਚ ਲੋਕਾਂ ਨੂੰ ਕੋਲਡ ਫੀਵਰ ਅਤੇ ਚਸਟ ਬਲੋਕ ਦੀ ਸਮੱਸਿਆ ਬਹੁਤ ਆਉਂਦੀ ਹੈ ਜ਼ਿਆਦਾ ਠੰਡ ਕਾਰਨ ਬੱਚਿਆਂ ਵਿੱਚ ਕੋਲਡ ਫੀਵਰ ਦੀ ਸਮੱਸਿਆ ਬਹੁਤ ਰਹਿੰਦੀ ਹੈ ਪਹਿਲੇ ਸਮੇਂ ਵਿੱਚ ਬਿਮਾਰੀਆਂ ਵੀ ਐਨੀਆਂ ਨਹੀਂ ਸਨ ਅਤੇ ਲੋਕ ਵੀ ਸਿਹਤਮੰਦ ਸਨ ਪਰ ਜਿਵੇਂ ਜਿਵੇਂ ਅੱਜ ਦਾ ਮਨੁੱਖ ਤਰੱਕੀ ਕਰਦਾ ਜਾ ਰਿਹਾ ਹੈ ਅਤੇ ਬਿਮਾਰੀਆਂ ਵੀ ਵੱਧਦੀਆਂ ਜਾ ਰਹੀਆਂ ਹਨ ਜੋ ਕਿ ਸਾਡੀ ਗਲਤ ਲਾਈਫ ਸਟਾਈਲ ਅਤੇ ਗਲਤ ਖਾਣ ਪੀਣ ਨਾਲ ਵੱਧ ਰਹੀਆਂ ਹਨ ਅਸੀਂ ਇਹ ਨਹੀਂ ਕਹਿ ਸਕਦੇ ਕਿ ਕਿਸ ਖੇਤਰ ਵਿੱਚ ਕਿਹੜੀ ਬਿਮਾਰੀ ਜ਼ਿਆਦਾ ਫੈਲ ਰਹੀ ਹੈ ਹੁਣ ਤਾਂ ਹਰ ਖੇਤਰ ਵਿੱਚ ਬਿਮਾਰੀਆਂ ਆਮ ਹੀ ਹੋ ਗਈਆਂ ਹਨ ਸਿਆਣਿਆਂ ਦਾ ਮੰਨਣਾ ਹੈ ਕਿ ਪਹਿਲਾਂ ਦੇ ਲੋਕ ਅੱਜ ਦੇ ਲੋਕਾਂ ਨਾਲੋਂ ਵੱਧ ਸਿਹਤਮੰਦ ਸਨ ਧੰਨਵਾਦ